ਹੈਲੋ ਲਵਿਸ਼ ਬੋਲਦਾ ਹੈ ਸਤਿ ਸ਼੍ਰੀ ਅਕਾਲ ਵੀਰੇ ਹੋਰ ਕਿਵੇਂ ਹੋ

ਹੋਰ ਕਿਵੇਂ ਵਧੀਆ ਸਾਰੇ ਹਾਂਜੀ ਵਧੀਆ ਜੀ ਅਸੀ ਵੀ ਤੇਅ ਮੈਂ ਚਾਹੁੰਦੀ ਸੀ ਵੀ ਅਗਰ ਆਪਣੇ ਘਰ ਦੇ ਸਾਹਮਣੇ ਖੱਡਾ ਹੈਗਾ ਟੋਇਆ ਬਣਿਆ ਪਿਆ ਜਿਹੜਾ ਵੀ ਉਹਨਾਂ ਨੇ ਤਾਂ ਕੀਤਾ ਨਹੀਂ ਕੋਈ ਹੱਲ ਮੁਨਸੀਪਲ ਵਾਲਿਆਂ ਨੇ ਇਹਦਾ ਹੱਲ ਆਪਾਂ ਨੂੰ ਹੀ ਕਰਨਾ ਪੈਣਾ ਅਤੇ ਕੋਈ ਹੈਗਾ ਪਛਾਣ ਜੇ ਕੋਈ ਮਿਸਤਰੀ ਜਿਹੜਾ ਪੈਪ ਸਹੀ ਕਰ ਦਏ ਪੈਪ ਵੀ ਲੀਕ ਹੋਈ ਪਈ ਹੈ ਨਾ

ਜਾਣ ਪਛਾਣ ਜੀ ਕਿ ਵੀ ਉਂਝ ਘਰ ਦਾ ਕੰਮ ਕਰਾਇਆ ਸੀ ਅੱਛਾ ਅਤੇ ਫਿਰ ਕਰ ਲਿਓ ਗੱਲ ਉਹਦੇ ਨਾਲ ਵੀ ਕੀ ਰੇਟ ਲਊਗਾ ਕੀ ਕੰਮ ਵੀ ਕਰ ਦੂਗਾ ਕੰਮ ਵਿਹਲਾ ਹਜੇ ਕਰ ਦਊਗਾ ਅਤੇ ਮਿੱਟੀ ਵਾਲਾ ਹੈਗਾ ਕੋਈ ਪਛਾਣ 'ਚ ਕਿ ਨਹੀਂ ਵੀ ਹਾਂ ਖੱਡਾ ਹੋਇਆ ਪਿਆ ਨਾ ਵੀ ਮੀਂਹ 'ਚ ਪਾਣੀ ਭਰ ਜਾਂਦਾ ਅਤੇ ਮਿੱਟੀ ਪਾ ਦੇਵਾਂਗੇ ਤਾਂ ਵਧੀਆ ਹੋ ਜਾਊਗਾ ਐਵੇਂ ਨਾ ਫਿਰ ਜਵਾਕ ਖੇਡਦੇ ਖੁਡਦੇ ਹੈਗੇ ਅਤੇ ਬਹੁਤ ਦਿੱਕਤ ਹੁੰਦੀ ਆ ਵੀ ਡਿੱਗਣ ਦਾ ਡਰ ਰਹਿੰਦਾ ਹੋਰ ਚੜ ਚੜਾਉਣ 'ਚ ਵੀ ਬਹੁਤ ਦਿੱਕਤ ਹੁੰਦੀ ਆ ਐਵੇਂ ਤਿਲਕਦੀ ਆ ਸਕੂਟਰੀ ਸਕੂਟਰੀ ਬਾਹਲੀ ਤਿਲਕਦੀ ਆ ਮੋਟਰਸਾਈਕਲ ਨਾਲੋਂ ਐਵੇਂ ਨਾ ਫਿਰ ਸੱਟਾਂ ਦਾ ਡਰ ਰਹਿੰਦਾ ਹੈਗਾ ਵੀ ਤਿਲਕ ਜਾਵੇ ਤਾਂ ਪਤਾ ਥੋੜ੍ਹੀ ਨਾ ਲੱਗਦਾ ਤਾਂ ਆਪਾਂ ਗਲੀ ਵਾਲਿਆਂ ਨੂੰ ਸਾਰਿਆਂ ਨੂੰ ਬੁਲਾ ਲਵਾਂਗੇ ਗੱਲ ਕਰਾਂਗੇ ਉਹਨਾਂ ਨਾਲ ਵੀ ਕੀ ਕਹਿੰਦੇ ਉਹ ਐ ਨਾ ਫਿਰ ਔਖਾ ਹੁੰਦਾ ਆਪਾਂ ਨੂੰ ਔਖਾ ਜ਼ਿਆਦਾ ਹੁੰਦਾ ਕਿਉਂਕਿ ਆਪਣੇ ਘਰ ਦੇ ਸਾਹਮਣੇ ਆ ਹੈਂ ਪੈਸੇ ਗਲੀ ਵਾਲਿਆਂ ਤੋਂ ਇਕੱਠੇ ਕਰ ਲਾਂਗੇ ਆਪਾਂ ਅਤੇ ਜਿਹੜਾ ਰੇਟ ਮਿਸਤਰੀ ਦੱਸੂਗਾ ਅਤੇ ਟਰਾਲੀ ਵਾਲੇ ਦਾ ਬਣੂਗਾ ਇਕੱਠਾ ਕਰਕੇ ਅਤੇ ਆਪਾਂ ਗਲੀ ਵਾਲਿਆਂ ਤੋਂ ਸਾਂਝੀ ਪੈਸੇ ਪਵਾ ਲਵਾਂਗੇ ਗੱਲ ਕਰ ਲਵਾਂਗੇ ਇਹਨਾਂ ਨਾਲ ਚਲੋ ਫਿਰ ਠੀਕ ਆ ਫਿਰ ਸ਼ਾਮੀ ਗੱਲ ਕਰਦੇ ਹਾਂ ਸਾਰੀ ਗਲੀ ਨੂੰ ਇਕੱਠੀ ਕਰਕੇ ਨਾਲੇ ਤੁਸੀਂ ਪਤਾ ਕਰ ਲਿਓ ਮਿਸਤਰੀ ਤੋਂ ਫਿਰ ਟਰਾਲੀ ਵਾਲਿਆਂ ਨੂੰ ਪਤਾ ਕਰਵਾ ਲਿਓ ਮਿੱਟੀ ਵਾਲੇ ਨੂੰ ਠੀਕ ਹੈ ਸਤਿ ਸ਼੍ਰੀ ਅਕਾਲ